ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਮਿੰਤਰਾ ਤੋ ਗੱਲ ਕਰ ਰਹੇ ਹੋ ਜੀ ਹਾਂਜੀ ਮੈਮ ਇੱਕ ਮੇਰਾ ਆਰਡਰ ਸੀਗਾ ਮਨਿੰਦਰ ਸਿੰਘ ਦੇ ਨਾਂ 'ਤੇ ਹਾਂਜੀ ਮੇਰਾ ਰਜਿਸਟਰਡ ਮੋਬਾਇਲ ਨੰਬਰ ਹੈ ਜੀ ਨੜਿਨਵੇਂ ਅੱਠ ਸੌ ਉਣਾਨਵੇਂ ਬਾਰਾਂ ਅੱਠ ਸੌ ਸੰਤਾਲੀ ਹਾਂਜੀ ਮੈਮ ਮੈਂ ਇੱਕ ਆਰਡਰ ਕੀਤਾ ਸੀ ਜੀਨ ਪੈਂਟ ਆਈ ਹੈ ਮੇਰੀ ਜੀਨ ਦੀ ਪੈਂਟ ਲਈ ਸੀ ਉਹ ਕੈਸ਼ ਓਨ ਡਿਲੀਵਰੀ ਲਈ ਸੀ ਅਤੇ ਪੇਮੈਂਟ ਵੀ ਕਰਤੀ ਸੀ ਲੇਕਿਨ ਉਹ ਪੈਂਟ ਮੈਮ ਦੋ ਧੋ ਪਾਏ ਆ ਅਤੇ ਬਿਲਕੁਲ ਹੀ ਖਰਾਬ ਹੋ ਗਈ ਹੈ ਜੀ ਪਹਿਲੀ ਗੱਲ ਤਾਂ ਉਹ ਦਾ ਕਲਰ ਬਿਲਕੁਲ ਫ਼ੇਟ ਹੋ ਗਿਆ ਜੀ ਦੂਸਰੀ ਕਲਰ ਉਹ ਇਕ ਉਹਨੂੰ ਹੁਣ ਟੈਗ ਲੱਗੇ ਹੋਏ ਆ ਟੈਗ 'ਤੇ ਤੁਸੀਂ ਅਰਿਜਨਲ ਲਗਾਏ ਹੋਏ ਆ ਅਲੇਨ ਕੂਪਰ ਦੇ ਲਗਾਏ ਹੋਏ ਅਰਿਜਨਲ ਨੇ ਲੇਕਿਨ ਬਿਲਕੁਲ ਬੇਕਾਰ ਨਿਕਲੀ ਆ ਮੈਮ ਮੈਂ ਤਾਂ ਹੈਰਾਨਗੀ ਹੋ ਰਹੀ ਆ ਕਿ ਸਿਰਫ਼ ਦੋ ਧੋ ਪਾਏ ਪੈਂਟ ਬਿਲਕੁਲ ਹੀ ਮੈਮ ਬਰਾਬਰ ਰੰਗ ਲਿਆ ਹੁੰਦਾ ਨਾ ਫਿਰ ਇੰਨੀ ਨੋਬਤ ਨਹੀਂ ਆਉਣੀ ਸੀ ਉਹਨਾਂ ਨੂੰ ਡੱਬ ਪੈ ਚੁੱਕੇ ਨੇ ਕਿਤੋਂ ਥੋੜ੍ਹਾ ਉਤਰਿਆ ਕਿਤੋਂ ਜ਼ਿਆਦਾ ਉਤਰਿਆ ਚੁਕਿਆ ਮੈਮ ਇਹਨਾਂ ਦਾ ਕੋਈ ਹੱਲ ਕਰੋ ਜੀ ਪਲੀਜ਼ ਮੈਨੂੰ ਦੱਸੋ ਕਿਵੇਂ ਮੈਂ ਇਸ ਦਾ ਹੱਲ ਕਿਵੇਂ ਇਹਨੂੰ ਜਾਂ ਐਕਸਚੇਂਜ ਜਾਂ ਐਕਸਚੇਂਜ ਛੱਡੋ ਮੈਮ ਮੈਂ ਇਸ ਨੂੰ ਵਾਪਿਸ ਹੀ ਕਰਨਾ ਚਾਹੁੰਦਾ ਐਕਸਚੇਂਜ ਨਹੀਂ ਐਕਸਚੇਂਜ ਕਰੂੰਗਾ ਤੁਸੀਂ ਹੋਰ ਇਸ ਤੋਂ ਵੀ ਬੇਕਾਰ ਭੇਜ ਦੇਓਂਗੇ ਕਿਰਪਾ ਇਹਦਾ ਹੱਲ ਕਰਕੇ ਦੱਸੋ ਅਤੇ ਮੈਨੂੰ ਜਲਦੀ ਤੋਂ ਜਲਦੀ ਮੈਮ ਇਸ ਬਾਰੇ ਦੱਸੋ ਅੱਛਾ ਜੀ ਉੱਥੇ ਜਾ ਕੇ ਠੀਕ ਹੈ ਜੀ ਅੱਛਾ ਐਪ 'ਤੇ ਜਾ ਕੇ ਕਰਨਾ ਜੀ ਓਕੇ ਮੈਮ